ਮੇਰੀ ਤਾਂ ਮਨ ਪਸੰਦ ਗੇਮ ਪਾਵਰਲਿਫਟਿੰਗ ਹੈ ਅਤੇ ਪਾਵਰਲਿਫਟਿੰਗ ਗੇਮ ਇਹ ਆ ਉਹਦੇ 'ਚ ਤਿੰਨ ਐਟਮਾਂ ਸ਼ਾਮਿਲ ਹੁੰਦੀਆਂ ਨੇ ਬੈਂਚ ਡੈੱਡ ਅਤੇ ਸਕੇਅਟ ਅਤੇ ਪਾਵਰਲਿਫਟਿੰਗ 'ਚ ਸਟਰੈਂਥ ਦੀ ਸਭ ਤੋਂ ਵੱਧ ਜ਼ਰੂਰਤ ਹੁੰਦੀ ਆ ਕਿਉਂਕਿ ਉਹਦੇ 'ਚ ਆਪਾਂ ਵੇਟ ਹੀ ਚੁੱਕਣਾ ਹੁੰਦਾ ਅਤੇ ਉਸ ਨਾਲ ਸਾਡਾ ਸਰੀਰ ਬੌਡੀ ਸਟਰਕਚਰ ਬੌਡੀ ਵਧੀਆ ਬਣਦੀ ਹੈ ਬੌਡੀ ਸਹੀ ਰਹਿੰਦੀ ਹੈ ਅਤੇ ਉਸ ਨਾਲ ਸਾਡੀ ਸਟਰੈਂਥ ਵੀ ਬਹੁਤ ਜ਼ਿਆਦਾ ਹਾਈ ਹੁੰਦੀ ਹੈ ਅਤੇ ਉਸਨੂੰ ਹਾਸਿਲ ਕਰਨ ਲਈ ਸਾਨੂੰ ਉਸ ਤਰ੍ਹਾਂ ਦੀ ਓ ਡਾਇਟ ਲੈਣੀ ਪੈਂਦੀ ਹੈ ਅਤੇ ਆਪਣੇ ਸਰੀਰ ਨੂੰ ਬਣਾਉਣਾ ਪੈਂਦਾ ਹੈ ਅਤੇ ਸਰੀਰ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ ਪਰ ਜੇਕਰ ਅਸੀਂ ਮਿਹਨਤ ਵਧੀਆ ਕਰਦੇ ਰਹਾਂਗੇ ਡਾਇਟ ਵਧੀਆ ਰਹਾਂਗੇ ਤਾਂ ਇਸ ਗੇਮ 'ਚ ਅਸੀਂ ਬਹੁਤ ਵਧੀਆ ਅੱਗੇ ਜਾਵਾਂਗੇ ਅਤੇ ਇਸ ਦੇ ਫ਼ਾਇਦੇ ਵੀ ਬਹੁਤ ਨੇ ਜਿਸ ਨਾਲ ਆਪਾਂ ਨੂੰ ਜੋਬਸ ਵਗੈਰਾ ਮਿਲਦੀਆਂ ਰਹਿੰਦੀਆਂ ਨੇ ਅਤੇ ਮੈਂ ਤਾਂ ਪਾਵਰਲਿਫਟਿੰਗ ਹੀ ਕਰੀ ਹੈ ਅਤੇ ਇਹਦਾ ਹੀ ਨੈਸ਼ਨਲ ਖੇਲਿਆ ਤਾਂ ਮੈਨੂੰ ਇਸ ਬਾਰੇ ਹੀ ਪਤਾ ਹੈ ਤਾਂ ਇਸ ਵਿੱਚ ਮੇਨ ਜੋ ਹੈ ਸਟਰੈਂਥ ਅਤੇ ਡਾਇਟ ਪਲੈਨ ਸਭ ਤੋਂ ਜ਼ਰੂਰੀ ਹੈ